ਹੈਲੋ ਹਾਂਜੀ ਅਮਨ ਕੀ ਹਾਲ ਚਾਲ ਬਸ ਠੀਕ ਹੈ ਹੋਰ ਅੱਜ ਕਿੱਥੇ ਆ ਠੀਕ ਹੈ ਅੱਛਾ ਅੱਛਾ ਹਾਂ ਹਾਂ ਗਏ ਨਹੀਂ ਕਿਤੇ ਹਾਏ ਬਹੁਤ ਜ਼ਿਆਦਾ ਅਮਨ ਮੈਨੂੰ ਖੁਦ ਇੰਨੀ ਪਰੇਸ਼ਾਨ ਹਾਂ ਨਾ ਟਰੈਫਿਕ ਤੋਂ ਤਾਂ ਟਰੈਫਿਕ ਈਸ਼ੂ ਆ ਰਾਮਾ ਮੰਡੀ ਜਿਹੜਾ ਇਹਨਾਂ ਨੇ ਫਲਾਈ ਓਵਰ ਬਣਾਇਆ ਬੜਾ ਗਲਤ ਜਿਹਾ ਸਿਸਟਮ ਕਰਤਾ ਨਾ ਸਾਰੀ ਭੀੜ ਜਿਹੜੀ ਹੈ ਨੀਚੇ ਦੀ ਜਾਂਦੀ ਹੈ ਮੈਂ ਵੀ ਕਈ ਵਾਰ ਹੁਣ ਜਿੱਦਾਂ ਤੁਹਾਨੂੰ ਪਤਾ ਫਗਵਾੜੇ ਜਾਣਾ ਹੁੰਦਾ ਅਗਰ ਫਗਵਾੜਾ ਵਾਲੇ ਆਪਾਂ ਉਹਦੇ 'ਤੇ ਹਾਈਵੇ 'ਤੇ ਜਾਈਏ ਨਾ ਬਹੁਤ ਹੀ ਜ਼ਿਆਦਾ ਟਰੈਫਿਕ ਜਿਹੜਾ ਆਪਾਂ ਨੂੰ ਫੇਸ ਕਰਨਾ ਪੈਂਦਾ ਔਰ ਨਹੀਂ ਨਹੀਂ ਨਹੀਂ ਰੋਡ ਵੱਡੇ ਵੱਡੇ ਬਸਿਸ ਵਗੈਰਾ ਜਿਹੜੀਆਂ ਨਾ ਟਰੈਫਿਕ ਦਾ ਕੋਈ ਸਿਸਟਮ ਨਹੀਂ ਹੈਗਾ ਕੁਝ ਹਾਂ ਕੁਝ ਲੋਕ ਵੀ ਫੋਲੋ ਨਹੀਂ ਕਰਦੇ ਜਾਂ ਕੁਝ ਲੋਕ ਵੀ ਫੋਲੋ ਨਹੀਂ ਕਰਦੇ ਟਰੈਫਿਕ ਰੋਜ਼ ਦੀ ਹਾਂ ਹਾਂ ਹਾਂ ਦੇਖੋ ਕੁਛ ਸਲਿਊਸ਼ਨ ਕੁਛ ਸਲਿਊਸ਼ਨ ਤਾਂ ਕੱਢਣੇ ਹੋਣਗੇ ਨਹੀਂ ਤਾਂ ਅਗਰ ਆਪਾਂ ਗੱਲ ਕਰੀਏ ਆਉਣ ਵਾਲੇ ਬੀਤ ਚੁੱਕੇ ਕੁਛ ਸਾਲਾਂ ਦੀ ਜੇ ਗੱਲ ਕਰਦੇ ਹਾਂ ਨਾ ਆਪਾਂ ਅਤੇ ਕਾਫੀ ਜ਼ਿਆਦਾ ਜਿਹੜੇ ਐਕਸੀਡੈਂਟ ਕੇਸ ਹੋਏ ਆ ਹੁਣ ਤੁਹਾਨੂੰ ਪਤਾ ਹੀ ਹੈ ਧੁੰਦਾਂ ਦੇ ਕਰਕੇ ਬਹੁਤ ਜ਼ਿਆਦਾ ਮੇਜਰ ਕੇਸਿਜ ਆਉਣੇ ਆ ਐਕਸੀਡੈਂਟਲ ਕੇਸਿਜ ਆ ਬਿਲਕੁਲ ਬਿਲਕੁਲ ਹਰ ਤਰ੍ਹਾਂ ਦੀ ਵੀ ਨਾਲੇ ਹਰ ਘਰ ਦੇ ਮੈਂਬਰ ਕੋਲ ਆਪਣੀ ਕਾਰ ਹੈ ਹਾਂਜੀ ਅਮਨ ਪਿਛਲੇ ਹਫਤੇ ਅਸੀਂ ਅੰਮ੍ਰਿਤਸਰ ਗਏ ਪਿਛਲੇ ਸੰਡੇ ਅੰਮ੍ਰਿਤਸਰ ਗਏ ਤੁਸੀਂ ਮੰਨਣਾ ਨਹੀਂ ਅਸੀਂ ਇੱਕ ਘੰਟਾ ਪ੍ਰੋਪਰ ਅਸੀਂ ਪਠਾਨਕੋਟ ਬਾਈਪਾਸ 'ਤੇ ਫਸੇ ਰਹੇ ਹਾਂ ਔਰ ਇੰਨਾ ਕੁ ਟਰੈਫਿਕ ਸੀਗਾ ਨਾ ਉੱਥੇ ਇੰਨੀ ਬੁਰੀ ਤਰੀਕੇ ਨਾਲ ਟਰੈਫਕ ਟਰੱਕ ਸੀਗਾ ਕਿ ਸਾਨੂੰ ਬਹੁਤ ਹੀ ਜ਼ਿਆਦਾ ਉੱਥੇ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਹਾਂਜੀ ਹਾਂਜੀ ਹਾਂਜੀ ਨਹੀਂ ਸੋਸ਼ਲ ਮੀਡੀਆ ਨੂੰ ਵੀ ਇਹਦੇ ਲਈ ਥੋੜ੍ਹਾ ਕੰਮ ਕਰਨਾ ਚਾਹੀਦਾ ਬਾਕੀ ਇਹ ਸਭ ਤਾਂ ਹੁਣ ਚੱਲੇਗਾ ਜਦੋਂ ਤੱਕ ਨਹੀਂ ਕੋਈ ਇਹਦਾ ਸਲਿਊਸ਼ਨ ਨਿਕਲੇਗਾ ਚਲੋ ਠੀਕ ਹੈ ਹਾਂਜੀ ਓਕੇ ਜੀ ਬਾਏ